ਦੋ ਜਨਵਰੀ ਉੱਨੀ ਸੌ ਸਤਾਨਵੇਂ ਇੱਕੀ ਅਗਸਤ ਉੱਨੀ ਸੌ ਨੜਿਨਵੇਂ ਪੰਜ ਜੁਲਾਈ ਉੱਨੀ ਸੌ ਸਤਾਨਵੇਂ ਅਠਾਈ ਅਗਸਤ ਅਠਾਈ ਅਗਸਤ ਦੋ ਹਜ਼ਾਰ ਉਣੱਤੀ ਅਗਸਤ ਦੋ ਹਜ਼ਾਰ ਇੱਕ